ਬਚਪਨ ਦੀਆਂ ਮੇਰੀਆਂ ਜਿਹੜੀਆਂ ਆਦਤਾਂ ਹਨ ਕੁਛ ਇਸ ਪ੍ਰਕਾਰ ਹਨ ਕਿ ਅ ਜੋ ਅਸੀਂ ਛੋਟੇ ਹੁੰਦੇ ਸੀ ਬਹੁਤ ਬੱਚ ਸਾਰੇ ਬੱਚੇ ਇਕੱਠੇ ਹੋ ਕੇ ਲੁਕਣ ਮਿਟੀ ਖੇਡਣਾ ਲੁਕਣ ਛਿਪਾਈ ਖੇਡਣਾ ਊਚ ਨੀਚ ਖੇਡਣਾ ਇੱਦਾਂ ਦੀਆਂ ਖੇਡਾਂ ਖੇਡਿਆ ਕਰਦੇ ਸੀਗੇ ਅਤੇ ਅੱਜ ਦੇ ਬੱਚੇ ਤਾਂ ਜਿਹੜੇ ਹੈ ਇਲੈਕਟ੍ਰ ਇਲੈਕਟ੍ਰੋਨਿਕ ਖਿਡੌਣਿਆਂ ਨਾਲ ਖੇਡਦੇ ਹਨ ਪਰ ਸਾਡੇ ਟਾਈਮ 'ਚ ਇਹ ਹੁੰਦਾ ਸੀ ਕਿ ਵੀ ਉਹੀ ਇੰਨਾ ਮਤਲਬ ਐਕਸਰਸਾਈਜ਼ ਫੁੱਲ ਸੀਗੀਆਂ ਕਿ ਹੁਣ ਬੱਚਿਆਂ ਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ ਪਰ ਪੁਰਾਣੇ ਸਮੇਂ 'ਚ ਉਹਨਾਂ ਗੇਮਾਂ ਵਿੱਚ ਹੀ ਐਕਸਰਸਾਈਜ਼ ਹੋ ਜਾਇਆ ਕਰਦੀ ਸੀ